ਲੋਕ ਨਾਚ ਜਿਵੇਂ ਕਿ ਪਹਿਲਾਂ ਆਪਾਂ ਪਰਮਪਰਿਕ ਜੋ ਪੰਜਾਬ ਦਾ ਲੋਕ ਨਾਚ ਹ ਸਾਨੂੰ ਪਤਾ ਹੀ ਹੈ ਕਿ ਭਗਤ ਭੰਗੜਾ ਤੇ ਗਿੱਧਾ ਹੈ ਭੰਗੜਾ ਜਿਵੇਂ ਕਿ ਆਪਾਂ ਨੂੰ ਪਤਾ ਸੀ ਜਿਵੇਂ ਭੰਗੜਾ ਜਿਹੜੇ ਹੁੰਦੇ ਆ ਬੰਦਿਆਂ ਦਾ ਠੀਕ ਹੈ ਉਹ ਮਰਦਾਂ ਦਾ ਨਾਚ ਹੈ ਠੀਕ ਹੈ ਜੋ ਜਦੋਂ ਜਦੋਂ ਭੰਗੜਾ ਪਾਉਂਦੇ ਆ ਉਦੋਂ ਕੁੜਤਾ ਪੱਗ ਤੇ ਕੀ ਕਹਿੰਦੇ ਆ ਧੋਤੀ ਪਾਉਂਦੇ ਹਨ ਜਿਵੇਂ ਕਿ ਗਿੱਦਾ ਗਿੱਦਾ ਜਿਵੇਂ ਮੁਟਿਆਰਾਂ ਦਾ ਲੋਕ ਨਾਚ ਹੈਗਾ ਠੀਕ ਹੈਗਾ ਠੀਕ ਹੈ ਪਹਿਲਾਂ ਇਹ ਸਾਫ ਸੁਥਰੇ ਢੰਗਾਂ ਨਾਲ ਪਰੰਪਰਾਗਤ ਜੋ ਸਾਡੇ ਲੋਕ ਨਾਚ ਸੀ ਉਹਨਾਂ ਨੂੰ ਪ੍ਰਦਰਸ਼ਿਤ ਕੀਤਾ ਜਾਂਦਾ ਸੀ ਪਰ ਹੁਣ ਜਿਵੇਂ ਕਿ ਪੱਛਮੀ ਸੱਭਿਆਤਾ ਦਾ ਬਹੁਤ ਹੀ ਜਿਆਦਾ ਪ੍ਰਭਾਵ ਪਿਆ ਹੈ ਸਾਡੇ ਲੋਕ ਨਾਚਾਂ ਦੇ ਉੱਤੇ ਸਾਡੇ ਹਰ ਹਰ ਵੱਖ ਵੱਖਰੇ ਵੱਖਰੇ ਸੱਭਿਆਚਾਰਾਂ ਦੇ ਉੱਤੇ ਪੱਛਮੀ ਸੱਭਿਅਤਾ ਦਾ ਬਹੁਤ ਜਿਆਦਾ ਪ੍ਰਭਾਵ ਪਿਆ ਹੈ ਜਿਸ ਨਾਲ ਸਾਡੇ ਜਿਵੇਂ ਪਿੰਡ ਦੇ ਹੋ ਕੇ ਸਾਡੇ ਲੋਕ ਨਾਚ ਗਿੱਧਾ ਤੇ ਭੰਗੜਾ ਤਾਂ ਹੋ ਹੀ ਗਏ ਉਹਨਾਂ ਦਾ ਵੀ ਉਹ ਹੁਣ ਪਹਿਲਾਂ ਜਿਵੇਂ ਪਾਂਦੇ ਸੀਗੇ ਭੰਗੜਾ ਤੇ ਕਿੱਦਾਂ ਹੁਣ ਉਸ ਨੂੰ ਹੋਰ ਪੱਛਮੀ ਸੱਭਿਆਚਾਰ ਦਾ ਥੋੜਾ ਜਿਹਾ ਪ੍ਰਭਾਵ ਇਹ ਵੀ ਪਿਆ ਹੈ ਕਿ ਜੋ ਮੁਟਿਆਰ ਹ ਜਾਂ ਜੋ ਮਰਦ ਹੈ ਉਹਨਾਂ ਦੇ ਉੱਤੇ ਜਿਹੜਾ ਪੱਛਮੀ ਸੱਭਿਆਚਾਰ ਦਾ ਪ੍ਰਭਾਵ ਪਿਆ ਹੈ ਉਹ ਇੱਕ ਉਹਨੂੰ ਗਲਤ ਨਜ਼ਰੀਏ ਨਾਲ ਵੀ ਲੈ ਗਏ ਹਨ ਹੁਣ ਅੱਜ ਕੱਲ ਮੁਟਿਆਰਾਂ ਬਹੁਤ ਹੀ ਪੱਛਮੀ ਸੱਭਿਆਚਾਰ ਦੇ ਪ੍ਰਭਾਵ ਦੇ ਹੇਠ ਆਈਆ ਹੋਈਆ ਜਿਵੇਂ ਕਿ ਉਹ ਹੁਣ ਬਹੁਤ ਜਿਆਦਾ ਐਕਸਪੋਜਲ ਕਰਦੀਆਂ ਹਨ ਉਹਨਾਂ ਦਾ ਹੋਰ ਬਹੁਤ ਬੁਰਾ ਪ੍ਰਭਾਵ ਵੀ ਸਾਡੇ ਪੱਛਮੀ ਸੱਭਿਆਚਾਰ ਦਾ ਥੋੜਾ ਬੁਰਾ ਪ੍ਰਭਾਵ ਵੀ ਕਹਿ ਲਓ ਸਾਡੇ ਸੱਭਿਆਚਾਰਾਂ ਦੇ ਉੱਤੇ ਸਾਡੇ ਲੋਕ ਨਾਚਾਂ ਉੱਤੇ ਪਿਆ ਹੋਇਆ ਹੈ